ਇੱਕ ਸ਼ੌਕੀਨ ਫਲਾਂਸ ਡਿਜਾਇਨਰ ਦੇ ਰੂਪ ਵਿੱਚ ਡਿਜੀਟਲ ਡਿਜ਼ਾਈਨ ਟੈਮਪਲੇਟ ਔਨਲੈਨ ਵੇਚਣ ਲਈ ਮੈਨੂੰ ਇੱਕ ਕਾਰੋਬਾਰ ਅਤੇ ਜੀ ਐੱਸ ਟੀ 'ਤੇ ਪ੍ਰਭਾਵ ਨੂੰ ਸਮਝਣ ਦੀ ਲੋੜ ਹੈ ਪਹਿਲਾਂ ਮੈਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਡਿਜੀਟਲ ਡਿਜਾਈਨ ਟੈਂਪਲਿਸਟ ਨੂੰ ਜੀ ਐੱਸ ਟੀ ਕਾਨੂੰਨਾਂ ਅਧੀਨ ਟੈਕਸਯੋਗ ਸਪਲਾਈ ਮੰਨਿਆ ਜਾਂਦਾ ਅਤੇ ਇਨ੍ਹਾਂ ਉਤਪਾਦਾਂ 'ਤੇ ਕਿਹੜੀਆਂ ਖ਼ਾਸ ਜੀ ਐੱਸ ਟੀ ਦਰਾਂ ਲਾਗੂ ਹੁੰਦੀਆਂ ਹੈ ਕੀ ਘਰੇਲੂ ਬਨਾਮ ਅੰਤਰਰਾਸ਼ਟਰੀ ਵਿਕਰੀ ਲਈ ਵੱਖਰੇ ਨਿਯਮ ਹੈਗੇ ਹੈ ਮੈਨੂੰ ਅੱਗੇ ਪਾਲਣਾ ਯਕੀਨੀ ਬਣਾਉਣ ਲਈ ਲੋੜਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਇਸ ਵਿੱਚ ਇਹ ਸ਼ਾਮਲ ਕੇ ਮੇਰੇ ਇਨਵੋਆਇਸਾਂ ਵਿੱਚ ਕਿਹੜੀ ਜਾਣਕਾਰੀ ਸ਼ਾਮਲ ਕੀਤੀ ਗਈ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕਿਵੇਂ ਫੋਰਵਰਡ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੈਨੂੰ ਜੀ ਐੱਸ ਟੀ ਉਦੇਸ਼ਾਂ ਲਈ ਲੋੜੀਂਦੇ ਰਿਕਾਡ ਕੀਪਿੰਗ ਅਭਿਆਸਾਂ ਨੂੰ ਨਿਰਧਾਰਿਤ ਕਰਨ ਦੀ ਲੋੜ ਹੈ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਮੈਨੂੰ ਕਿੰਨੀ ਦੇਰ ਤੱਕ ਰਿਕਾਡ ਰੱਖਣੇ ਚਾਹੀਦੇ ਹੈ ਅਤੇ ਕਿਹੜੇ ਵੇਰਵਿਆਂ ਦਾ ਦਸਤਾਵੇਜ਼ ਹੋਣਾ ਚਾਹੀਦਾ ਹੈ ਇਨ੍ਹਾਂ ਪਹਿਲੂਆਂ ਨੂੰ ਸਮਝਣ ਨਾਲ ਮੈਨੂੰ ਆਪਣੀਆਂ ਟੈਕਸ ਜ਼ਿੰਮੇਵਾਰੀਆਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਅਤੇ ਸੰਭਾਵੀ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲੇਗੀ ਮਿਲੂਗੀ ਕਿਸੇ ਟੈਕਸ ਪੇਸ਼ੇਵਰ ਨਾਲ ਸਲਾਹ ਮਸ਼ਵਰਾ ਕਰਨਾ ਕੀਮਤੀ ਸਮਝ ਪ੍ਰਦਾਨ ਕਰ ਸਕਦਾ ਅਤੇ ਇਹ ਯਕੀਨੀ ਬਣਾ ਸਕਦਾ ਹੈ ਕਿ ਮੈਂ ਜੀ ਐੱਸ ਟੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹਾਂ